ਹਾਂ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਮੈਂ ਤੁਹਾਡੇ ਪੇਜ ਤੋਂ ਇੱਕ ਦਿਲਦਰੀ ਔਡਰ ਕੀਤੀ ਸੀ ਮੇਰਾ ਨਾਮ ਰਿਤਿਕਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਡਿਲੀਵਰੀ ਮੈਨੂੰ ਟਾਈਮ 'ਤੇ ਮਿਲ ਗਈ ਸੀ ਅੱਗੇ ਮੈਂ ਤੁਹਾਨੂੰ ਪੈਕਿੰਗ ਬਾਰੇ ਦੱਸਣਾ ਚਾਹੂੰਗੀ ਕਿ ਜਿਸ ਇਸਦੀ ਪੈਕਿੰਗ ਬਹੁਤ ਹੀ ਵਧੀਆ ਤਰੀਕੇ ਨਾਲ਼ ਹੋਈ ਸੀ ਅਤੇ ਇਸਦਾ ਜੋ ਪਲਾਸਟਿਕ ਹੈ ਉਹ ਵੀ ਮੈਨੂੰ ਬਹੁਤ ਹੀ ਸਟਰੋਂਗ ਰਿਸੀਵ ਹੋਇਆ ਹੈ ਮੈਂ ਦੋ ਚੀਜ਼ਾਂ ਔਡਰ ਕੀਤੀਆਂ ਸੀ ਮਿਕਸਰ ਪਲੱਸ ਗਰਾਂਈਡਰ ਇਸਦਾ ਪਲਾਸਟਿਕ ਵੀ ਬਹੁਤ ਅੱਛਾ ਹੈ ਅਤੇ ਇਸਦੇ ਪਲੇਟਸ ਵੀ ਬਹੁਤ ਸਟਰੋਂਗ ਹਨ ਅਤੇ ਬਹੁਤ ਹੀ ਵਧੀਆ ਹਨ ਇਸਦੀ ਵਾਇਰ ਬਹੁਤ ਜ਼ਿਆਦਾ ਲੰਬੀ ਹੈ ਮੈਂ ਇਸਨੂੰ ਕਿਤੇ ਵੀ ਰੱਖ ਕੇ ਯੂਸ ਕਰ ਸਕਦੀ ਹਾਂ ਅਤੇ ਜਿਵੇਂ ਮੈਨੂੰ ਇਸ ਬਾਰੇ ਨਹੀਂ ਪਤਾ ਸੀ ਕਿ ਇਸਦੀ ਇੱਕ ਸਾਲ ਦੀ ਗਰੰਟੀ ਵੀ ਹੋਵੇਗੀ ਜੋ ਕਿ ਮੈਨੂੰ ਗਰੰਟੀ ਕਾਰਡ ਰਿਸੀਵ ਹੋ ਚੁੱਕਿਆ ਹੈ ਅਤੇ ਜਿਵੇਂ ਤੁਸੀਂ ਮੈਨੂੰ ਕਲਰ ਇੰਸਟਾਗ੍ਰਾਮ 'ਤੇ ਦਿਖਾਇਆ ਸੀ ਬਲੈਕ ਅਤੇ ਬਲਿਊ ਮੈਨੂੰ ਸੇਮ ਐਜ਼ ਇਟ ਇਜ਼ ਐਜ਼ ਉਹੀ ਕਲਰ ਰਿਸੀਵ ਹੋਇਆ ਹੈ ਅਤੇ ਇਸ ਦਿਨ ਜਿਸਦੇ ਇਸਦੇ ਨਾਲ ਮੈਨੂੰ ਤੀਹ ਪ੍ਰਸੈਂਟ ਡਿਸਕਾਊਂਟ ਜੋ ਪ੍ਰਾਪਤ ਹੋਇਆ ਹੈ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਗੇ ਮੇਰੇ ਸਾਰੇ ਫਰੈਂਡਸ ਬਹੁਤ ਹੀ ਸ਼ੋਕ ਹਨ ਕਿ ਮੈਨੂੰ ਇੰਨੇ ਘੱਟ ਦਾਮ 'ਤੇ ਐਨੀ ਵਧੀਆ ਚੀਜ਼ ਰਿਸੀਵ ਹੋ ਗਈ ਹੈ ਮੇਰੇ ਸਾਰੇ ਫਰੈਂਡਸ ਅੱਗੇ ਫਰਿੱਜ ਕੂਲਰ ਟੀ ਵੀ ਵਾਸ਼ਿੰਗ ਮਸ਼ੀਨ ਹੋਰ ਵੀ ਕੁਛ ਸਮਾਨ ਤੁਹਾਡੇ ਪੇਜ ਤੋਂ ਹੀ ਜੋ ਕਿ ਹੈ ਔਡਰ ਕਰਨਗੇ ਅਤੇ ਮੈਂ ਵੀ ਆਪਣੀ ਕੰਟੀਨਿਊ ਸ਼ੋਪਿੰਗ ਤੁਹਾਡੇ ਪੇਜ ਤੋਂ ਹੀ ਕਰਾਂਗੀ ਧੰਨਵਾਦ ਜੀ